ਪੰਜ ਸੌ ਤਰਤਾਲੀ ਦੋ ਹਜ਼ਾਰ ਪੰਜ ਸੌ ਪੰਜਾਹ ਛੇ ਹਜ਼ਾਰ ਤਿੰਨ ਸੌ ਤੇਰ੍ਹਾਂ ਪੰਜ ਲੱਖ ਤਰਤਾਲੀ ਹਜ਼ਾਰ ਛੇ ਸੌ ਪੰਦਰ੍ਹਾਂ ਅੱਠ ਲੱਖ ਬਾਹਠ ਹਜ਼ਾਰ ਨੌ ਸੌ ਪੱਚੀ